ਡਾਂਸ ਮੁੰਡੇ ਅਤੇ ਕੁੜੀਆਂ ਦੋਨਾਂ ਵਲੋਂ ਕੀਤਾ ਜਾਂਦਾ ਹੈ ਡਾਂਸ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਕੀਤਾ ਜਾਂਦਾ ਹੈ ਡਾਂਸ ਵਿੱਚ ਬਹੁਤ ਸਾਰੇ ਸਟੈਪ ਅਜਿਹੇ ਹੁੰਦੇ ਨੇ ਜਿੰਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਜਿਵੇਂ ਝੂਮਰ ਡਾਂਸ ਭੰਗੜਾ ਲੁੱਡੀ ਡਾਂਸ ਅਜਿਹੇ ਬਹੁਤ ਸਾਰੇ ਡਾਂਸ ਨੇ ਜਿਨ੍ਹਾਂ ਦੀ ਸਾਨੂੰ ਹਜੇ ਪੂਰੀ ਤਰ੍ਹਾਂ ਨਾਮ ਵੀ ਨਹੀਂ ਪਤਾ ਅਤੇ ਇਸੇ ਅਸੀਂ ਇਹ ਗਲਤਫ਼ਹਿਮੀ ਵਿੱਚ ਰਹਿੰਦੇ ਹਾਂ ਕਿ ਡਾਂਸ ਕਿਸੇ ਵੀ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਕਰਨਾ ਬਹੁਤ ਅਸਾਨ ਹੈ ਪਰ ਅਜਿਹਾ ਨਹੀਂ ਹੈ ਡਾਂਸ ਕਰਨ ਦਾ ਬਹੁਤ ਡਾਂਸ ਕਰਨ ਦੇ ਬਹੁਤ ਤਰੀਕੇ ਨੇ ਜਿਨ੍ਹਾਂ ਤੋਂ ਅਸੀਂ ਜਾਣੂ ਨਹੀਂ ਹੁੰਦੇ ਡਾਂਸ ਨੂੰ ਕਰਨ ਦਾ ਹਰੇਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਹਰ ਇੱਕ ਦੇਸ਼ ਵਿੱਚ ਕੋਈ ਨਾ ਕੋਈ ਡਾਂਸ ਬਹੁਤ ਮਹੱਤਵਪੂਰਨ ਹੁੰਦਾ ਹੈ ਜਿਵੇਂ ਸਾਡੇ ਪੰਜਾਬ ਵਿੱਚ ਗਿੱਧਾ ਅਤੇ ਭੰਗੜਾ ਪ੍ਰਸਿੱਧ ਹੈ ਇਹ ਅਸੀਂ ਖੁਸ਼ੀ ਦੇ ਮੌਕੇ ਵਿੱਚ ਪਾਉਂਦੇ ਹਾਂ ਉਸ ਤਰ੍ਹਾਂ ਹੀ ਇੱਕ ਦੇ ਅ ਹਰ ਇੱਕ ਦੇਸ਼ ਵਿੱਚ ਆਪਣਾ ਆਪਣਾ ਨਾਚ ਪ੍ਰਸਿੱਧ ਹੁੰਦਾ ਹੈ ਜਿਹੜੀਆਂ ਡਾਂਸ ਦੇ ਪ੍ਰਤੀ ਸਾਡੀਆਂ ਗਲਤਫ਼ਹਿਮੀਆਂ ਹੁੰਦੀਆਂ ਨੇ ਬਿਨਾਂ ਕਿਸੇ ਦੱ ਬਿਨਾਂ ਕਿਸੇ ਦੇ ਦੱਸੇ ਅਸੀਂ ਉਨ੍ਹਾਂ ਗੱਲਾਂ ਦਾ ਪਤਾ ਨਹੀਂ ਕਰ ਸਕਦੇ ਧੰਨਵਾਦ